ਮੇਰੀ ਮਨ ਪਸੰਦ ਬਾਈਕ ਬੁਲਟ ਹੈ ਮੇਰੇ ਕੋਲ ਬੁਲਟ ਬਾਈਕ ਹੈ ਜੋ ਕਿ ਬਹੁਤ ਹੀ ਸੋਹਣਾ ਹੈ ਉਸਦਾ ਰੰਗ ਕਾਲਾ ਹੈ ਮੈਨੂੰ ਉਸਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮਤਲਬ ਉਸਨੂੰ ਚਲਾਉਣਾ ਉਸਦੇ ਉੱਤੇ ਲੋਂਗ ਡਰਾਇਵ 'ਤੇ ਜਾਣਾ ਮਤਲਬ ਬਹੁਤ ਵਧੀਆ ਲੱਗਦਾ ਹੈ ਅਤੇ ਪਰ ਮੇਰੀ ਡਰੀਮ ਬਾਈਕ ਯਾਮਾ ਆਰ ਵਨ ਪੰਦਰ੍ਹਾਂ ਹੈ ਉਸ ਦੀ ਹਾਈ ਸਪੀਡ ਉਹ ਬਹੁਤ ਕੰਫਰਟੇਬਲ ਰਹਿੰਦਾ ਹੈ ਲੋਂਗ ਡਰਾਈਵ ਸਮੂਥ ਰਾਈਡਿੰਗ ਲਈ ਬਹੁਤ ਹੀ ਜ਼ਿਆਦਾ ਵਧੀਆ ਐਂਡ ਬਾਈਕਿੰਗ ਲਈ ਕਾਵਾਸਾਕੀ ਨਿੰਜਾ ਜੈੱਡ ਵਨ ਆਰ ਹੈ ਜੋ ਕਿ ਬਾਈਕਿੰਗ ਯਾਤਰਾਵਾਂ ਲਈ ਆਰਾਮਦਾਇਕ ਹੁੰਦੀ ਹੈ ਕਿਉਂਕਿ ਉਹਦਾ ਇੰਜਨ ਕਾਫੀ ਵੱਡਾ ਹੁੰਦਾ ਹੈ ਅਤੇ ਉਸਦੀ ਸੀਟ ਕਾਫੀ ਕੰਫਰਟੇਬਲ ਹੁੰਦੀ ਹੈ ਐਂਡ ਉਸਦੇ ਹੈਂਡਲ ਚਲਾਉਣ ਲਈ ਕਾਫੀ ਵਧੀਆ ਮਤਲਬ ਲੱਗਦੇ ਆ ਉਸ ਉੱਤੇ ਬੰਦੇ ਨੂੰ ਇੰਨੀ ਥਕਾਵਟ ਨਹੀਂ ਹੁੰਦੀ ਔਰ ਉਸਨੂੰ ਚਲਾਉਣ 'ਚ ਵੀ ਬਹੁਤ ਹੀ ਜ਼ਿਆਦਾ ਵਧੀਆ ਫੀਲ ਹੁੰਦਾ ਹੈ ਉਹਦੀ ਸੀਟ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੀ ਆ ਬੰਦਾ ਮਤਲਬ ਉਸ ਉੱਤੇ ਬਹਿ ਕੇ ਕਿਤੇ ਵੀ ਲੋਂਗ ਡਰਾਈਵ 'ਤੇ ਜਾ ਸਕਦਾ ਹੈ ਬਹੁਤ ਹੀ ਜ਼ਿਆਦਾ ਸੀਟ ਕੰਫਰਟੇਬਲ ਹੁੰਦੀ ਹੈ ਮਤਲਬ ਮੇਰੀ ਡਰੀਮ ਬਾਈਕ ਤਾਂ ਮੇਰੀ ਯਾਮਾ ਆਰ ਵਨ ਪੰਦਰ੍ਹਾਂ ਹੈ ਬਟ ਇਹ ਜ਼ਿਆਦਾਤਰ ਜ਼ਿਆਦਾ ਬਾਈਕਿੰਗ ਲਈ ਕਾਵਾਸਾਕੀ ਨਿੰਜਾ ਜੈੱਡ ਵਨ ਆਰ ਹੈ ਇਸ ਉੱਤੇ ਅਸੀਂ ਕਿਤੇ ਵੀ ਦੂਰ ਜਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਕੰਫਰਟੇਬਲ ਰਹਿ ਸਕਦੇ ਹਾਂ ਸਾਨੂੰ ਕੋਈ ਵੀ ਮੁਸ਼ਕਿਲ ਨਹੀਂ ਆ ਸਕਦੀ ਥੈਂਕ ਯੂ